ਬਾਗਬਾਨੀ ਇੱਕ ਬਹੁਤ ਹੀ ਕੁਦਰਤ ਨਾਲ ਜੁੜੀ ਹੋਈ ਚੀਜ਼ ਹੈ ਜਿਹਦੇ ਵਿੱਚ ਅਸੀਂ ਕੁਦਰਤ ਦੇ ਨਾਲ ਜੁੜਨ ਦੇ ਨਾਲ ਨਾਲ ਆਪਣੀ ਮਾਨਸਿਕਤਾ ਅਤੇ ਸਾਡੇ ਸਰੀਰਕ ਤੌਰ 'ਤੇ ਵੀ ਬਹੁਤ ਜ਼ਿਆਦਾ ਸਾਨੂੰ ਸ਼ਾਂਤ ਅਤੇ ਸਾਡੇ ਮਨ ਨੂੰ ਵਧੀਆ ਕਰਦੀ ਹੈ ਜਿਸ ਤਰ੍ਹਾਂ ਕਿ ਪੇੜ ਪੌਦੇ ਫੁੱਲ ਲਗਾਉਣਾ ਮੈਨੂੰ ਇੱਕ ਬਹੁਤ ਹੀ ਜ਼ਿਆਦਾ ਅੱਛਾ ਸ਼ੌਂਕ ਲੱਗਦਾ ਹੈ ਮੈਂ ਬਚਪਨ ਤੋਂ ਹੀ ਫੁੱਲਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਰੰਗ ਬਰੰਗੇ ਫੁੱਲ ਅਤੇ ਉਹਨਾਂ ਦੀਆਂ ਵੱਖੋ ਵੱਖਰੇ ਕਿਸਮਤ ਕਿਸਮਾਂ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਦਿਲਚਸਪੀ ਰੱਖਦੀ ਸੀ ਸੋ ਇਸ ਕਰਕੇ ਹੀ ਮੈਨੂੰ ਬਾਗਬਾਨੀ ਦਾ ਸ਼ੌਂਕ ਪਿਆ ਕਿਉਂਕਿ ਮੇਰੇ ਘਰ ਵਿੱਚ ਵੀ ਮੇਰੇ ਪਰਿਵਾਰ ਵਿੱਚ ਮੇਰੇ ਦਾਦਾ ਦਾਦੀ ਮੇਰੇ ਮੰਮਾ ਪਾਪਾ ਸਾਰੇ ਦੇ ਸਾਰੇ ਲੋਕ ਅਸੀਂ ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਰੰਗ ਬਰੰਗੇ ਫੁੱਲਾਂ ਦੇ ਬੂਟੇ ਲਗਾਉਣਾ ਪਸੰਦ ਕਰਦੇ ਸੀ ਉਹਨਾਂ ਨੂੰ ਵੇਖ ਕੇ ਮੇਰੇ ਖੁਦ ਦੇ ਮਨ ਵਿੱਚ ਵੀ ਆਇਆ ਕਿ ਮੈਨੂੰ ਇਹ ਕੰਮ ਸਟਾਰਟ ਕਰਨਾ ਚਾਹੀਦਾ ਹੈ ਸੋ ਉਦੋਂ ਤੋਂ ਹੀ ਜਦੋਂ ਮੈਂ ਇੱਕ ਪੇੜ ਨੂੰ ਲੱਗ ਕੇ ਜਾਂ ਪੌਦੇ ਨੂੰ ਛੋਟੇ ਫੁੱਲ ਨੂੰ ਲੱਗ ਕੇ ਛੋਟੇ ਨੂੰ ਲਗਾ ਕੇ ਉਹਨੂੰ ਵੱਡੇ ਹੁੰਦਾ ਦੇਖਦੀ ਸੀ ਤਾਂ ਉਹ ਚੀਜ਼ ਮੇਰੇ ਮਨ ਨੂੰ ਬਹੁਤ ਅੱਛੀ ਲੱਗਦੀ ਸੀ ਮੈਨੂੰ ਐਵੇਂ ਲੱਗਦਾ ਹੈ ਜਿਵੇਂ ਜਾਨਵਰਾਂ 'ਚ ਪੰਛੀਆਂ 'ਚ ਸਭ 'ਚ ਜਾਨ ਹੁੰਦੀ ਹੈ ਉਸ ਤਰ੍ਹਾਂ ਹੀ ਇੱਕ ਪੇੜ ਪੌਦਿਆਂ 'ਚ ਜਾਨ ਹੁੰਦੀ ਹੈ ਉਹਨਾਂ ਨੂੰ ਪਾਲਣਾ ਉਹਨਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਨੂੰ ਪਾਣੀ ਦੇਣਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਇਹ ਸ਼ੌਂਕ ਮੇਰੇ ਮਨ ਦੇ ਅੰਦਰ ਛੋਟੇ ਹੁੰਦਿਆਂ ਤੋਂ ਹੀ ਹੈ ਅਤੇ ਮੈਨੂੰ ਲੱਗਦਾ ਇਹ ਸ਼ੌਂਕ ਮੇਰੇ ਨਾਲ ਸ਼ ਸਦਾ ਰਹੇਗਾ ਇਹਨਾਂ ਪੇੜ ਪੌਦਿਆਂ ਨੂੰ ਉਗਦੇ ਵੇਖ ਕੇ ਮੇਰੇ ਮਨ ਦੇ ਅੰਦਰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਮੈਂ ਇਹਨਾਂ ਨੂੰ ਜਿੰਨਾ ਹੋ ਸਕੇ ਸਮੇਂ ਸਿਰ ਪਾਣੀ ਦੇ ਕੇ ਇਹਨਾਂ ਨੂੰ ਵੱਡਾ ਕਰਨਾ ਚਾਹੁੰਦੀ ਹਾਂ ਤਾਂ ਇਹਨਾਂ ਦਾ ਟਾਈਮ ਟੂ ਟਾਈਮ ਧਿਆਨ ਰੱਖਣਾ ਗਰਮੀ ਸਰਦੀ ਦਾ ਹਰ ਚੀਜ਼ ਦਾ ਧਿਆਨ ਰੱਖਣਾ ਮੈਨੂੰ ਪਸੰਦ ਹੈ ਇਹਦੇ ਨਾਲ ਮੇਰੇ ਮਨ ਦੇ ਨਾਲ ਨਾਲ ਮੇਰਾ ਸਰੀਰਕ ਤੌਰ 'ਤੇ ਵੀ ਬਹੁਤ ਫਰਕ ਪੈਂਦਾ ਹੈ ਕਿਉਂਕਿ ਜਦੋਂ ਅਸੀਂ ਜਿੰਨਾ ਹੀ ਜ਼ਿਆਦਾ ਹਰੇ ਭਰੇ ਰੁੱਖਾਂ ਦੇ ਨਾਲ ਪੇੜਾਂ ਦੇ ਨਾਲ ਜੁੜਦੇ ਹਾਂ ਅਤੇ ਓਨਾ ਅਸੀਂ ਸਾਡੇ ਸਰੀਰਕ ਵਜੋਂ ਵੀ ਸਾਨੂੰ ਚੰਗਾ ਲੱਗਦਾ ਹੈ ਮੇਰੇ ਘਰ ਦੇ ਅੰਦਰ ਅਲੱਗ ਅਲੱਗ ਤਰ੍ਹਾਂ ਦੇ ਪੇੜ ਪੌਦੇ ਹਨ ਅਤੇ ਮੈਨੂੰ ਨਵੇਂ ਤੋਂ ਨਵਾਂ ਫੁੱਲ ਉਗਾਉਣਾ ਚੰਗਾ ਲੱਗਦਾ ਹੈ